ਪੰਜਾਬ ਦਾ ਜਿਹੜਾ ਆਪਣਾ ਵਪਾਰਕ ਖੇਤਰ ਹੈ ਉਹ ਜਿਹੜੇ ਸਥਾਨਕ ਭਾਈਚਾਰੇ ਨੂੰ ਬੜੇ ਹੀ ਚੰਗੇ ਤਰੀਕੇ ਨਾਲ ਜਿਹੜਾ ਹੈ ਉਹ ਸੇਵਾ ਕਰਦਾ ਹੈ ਹਾਲ ਹੀ 'ਚ ਮੈਂ ਐਚ ਡੀ ਐੱਫ ਸੀ ਬੈਂਕ ਦੀ ਜੇ ਗੱਲ ਕਰਾਂ ਜਿਹੜਾ ਪੰਜਾਬ ਦਾ ਇਹਨਾਂ ਦਾ ਹੈਡਕੁਆਰਟਰ ਔਫੀਸ ਹੈ ਉਹ ਇੱਕ ਬੜੇ ਹੀ ਵਧੀਆ ਤਰੀਕੇ ਨਾਲ ਇੱਕ ਸੀ ਐਸ ਆਰ ਐਕਟੀਵਿਟੀ ਨੂੰ ਚਲਾਉਂਦਾ ਹੈ ਜਿਹਦਾ ਨਾਮ ਹੈ ਪਰਿਵਰਤਨ ਉਹ ਕਿਆ ਕਰਦਾ ਹੈ ਜਿਹੜੇ ਸਥਾਨਕ ਜਿਹੜੇ ਲੋਕ ਹੈ ਉਹਨਾਂ ਨੂੰ ਨਵੀਂ ਨਵੀਂ ਚੀਜ਼ਾਂ ਸਿਖਾਉਣ ਲਈ ਇਸ ਤਰੀਕੇ ਦੇ ਇਵੈਂਟਸ ਕਰਵਾਉਂਦਾ ਹੈ ਤਾਂ ਕਿ ਜਿਹੜੇ ਆਸ ਪੜੋਸ ਦੇ ਬੱਚੇ ਹਨ ਉਹ ਫਰੀ 'ਚ ਜਿਹੜੀ ਸਿੱਖਿਆ ਹੈ ਉਹ ਲੈ ਸਕਣ ਅਤੇ ਜਿਹੜੇ ਵੀ ਲੋਕ ਆਪਣੇ ਪੈਸੇ ਨਹੀਂ ਕਮਾ ਸਕਦੇ ਜਾਂ ਬੱਚੇ ਜਿਹੜਾ ਆਪਣੀ ਜਿਹੜੀ ਸੁਵਿਧਾਵਾਂ ਹੈ ਉਹਨੂੰ ਨਹੀਂ ਲੈ ਸਕਦੇ ਉਹ ਜਿਹੜਾ ਪਰਿਵਰਤਨ ਹੈ ਅਤੇ ਇਹਨਾਂ ਦਾ ਜਿਹੜਾ ਵਪਾਰਕ ਖੇਤਰ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੂੰ ਅੱਗੇ ਵਧਣ 'ਚ ਮਦਦ ਕਰਦਾ ਹੈ